ਮੇਰਾ ਨਾਂ ਛਾਇਆ ਮੈਂ ਅਕਤੂਬਰ ਮਹੀਨੇ 'ਚ ਮੀਸ਼ੋ ਤੋਂ ਇੱਕ ਸ਼ੂਜ਼ ਔਡਰ ਕੀਤੇ ਸੀਗੇ ਜਿਨ੍ਹਾਂ ਦਾ ਰੰਗ ਨੀਲਾ ਅਤੇ ਚਿੱਟਾ ਸੀ ਅਤੇ ਇਹ ਸੂਜ਼ ਦੇਖਣ ਦੇ ਵਿੱਚ ਕਾਫੀ ਪ੍ਰਭਾਵਿਤ ਸੀਗੇ ਅਤੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਸੂਜ਼ ਔਡਰ ਕਰਤੇ ਇਸ ਤੋਂ ਪਹਿਲਾਂ ਵੀ ਮੈਂ ਔਨਲਾਈਨ ਸ਼ੋਪਿੰਗ ਕਰਦੀ ਰਹੀ ਹਾਂ ਅਤੇ ਮੈਨੂੰ ਲੱਗਦਾ ਲਗਭਗ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਇਹ ਸ਼ੂਜ਼ ਮੈਨੂੰ ਡਿਲੀਵਰਡ ਹੋ ਗਏ ਸੀ ਅਤੇ ਜਦੋਂ ਮੈਂ ਇਹ ਸ਼ੂਜ਼ ਦਾ ਡੱਬਾ ਖੋਲ੍ਹਿਆ ਤਾਂ ਮੈਂ ਸ਼ੂਜ਼ ਦੇਖੇ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਇਹ ਬਿਲਕੁਲ ਹੀ ਫੋਟੋ ਤੋਂ ਅੱਡ ਸੀਗੇ ਫੋਟੋ ਦੇ ਵਿੱਚ ਇਹ ਬਹੁਤ ਸੋਹਣੇ ਲੱਗ ਰਹੇ ਸੀਗੇ ਅਤੇ ਬਹੁਤ ਹੀ ਪ੍ਰਭਾਵਿਤ ਸੀਗੇ ਲੇਕਿਨ ਪਰ ਜਦੋਂ ਮੈਂ ਰੀਅਲ ਦੇ ਵਿੱਚ ਇਸ ਸ਼ੂਜ਼ ਨੂੰ ਦੇਖਿਆ ਤਾਂ ਇਹ ਬਹੁਤ ਜ਼ਿਆਦਾ ਹੀ ਘਟੀਆ ਕੁਆਲਿਟੀ ਦੇ ਸੀਗੇ ਅਤੇ ਆਲਰੇਡੀ ਡੈਂਮੇਜ ਸੀਗੇ ਅਤੇ ਹੋਰ ਵੀ ਬਹੁਤ ਕੁਛ ਸੀ ਮੈਨੂੰ ਇਹ ਦੇਖਣ ਦੇ ਵਿੱਚ ਬਿਲਕੁਲ ਨਹੀਂ ਅੱਛੇ ਲੱਗੇ ਅਤੇ ਨਾ ਹੀ ਇਹਨਾਂ ਸ਼ੂਜ ਦੇ ਵਿੱਚ ਰਿਟਰਨ ਪੋਲੀਸੀ ਸੀ ਅਤੇ ਮੇਰੇ ਪੈਸੇ ਜਿਹੜੇ ਸੀ ਉਹ ਬਿਲਕੁਲ ਹੀ ਪਾਣੀ ਦੇ ਵਿੱਚ ਡੁੱਬ ਗਏ